ਸਾਡੇ ਪਰਿਵਾਰ ਵਿੱਚ ਕੁਝ ਸੱਭਿਆਚਾਰਕ ਪਰੰਪਰਾਵਾਂ ਹੁਣ ਵੀ ਅਜਿਹੀਆਂ ਰਹੀਆਂ ਹਨ ਜਿਹੜੀਆਂ ਕਿ ਪਰੰਪਰਾ ਤੋਂ ਚੱਲੀਆਂ ਆਉਂਦੀਆਂ ਹਨ ਜਿਹਨਾਂ ਦਾ ਅਸੀਂ ਅੱਜ ਵੀ ਅਭਿਆਸ ਕਰਦੇ ਹਾਂ ਜਿਵੇਂ ਤਿਉਹਾਰਾਂ ਦੇ ਬਾਰੇ ਗੱਲ ਕੀਤੀ ਜਾਵੇ ਤਾਂ ਸਾਰੇ ਤਿਉਹਾਰ ਉਸੇ ਤਰ੍ਹਾਂ ਦੇ ਨਾਲ ਹੀ ਮਨਾਏ ਜਾਂਦੇ ਹਨ ਜਿਵੇਂ ਕਿ ਦੁਸਹਿਰੇ ਦਾ ਤਿਉਹਾਰ ਮਨਾਇਆ ਜਾਂਦਾ ਹੈ ਉਹ ਜਿਵੇਂ ਪੁਰਾਤਨ ਸਮੇਂ ਵਿੱਚ ਆਰੰਭ ਤੋਂ ਸ਼ੁਰੂ ਹੋਇਆ ਸੀ ਅਸੀਂ ਵੀ ਅੱਜ ਉਸੇ ਤਰ੍ਹਾਂ ਨਾਲ ਉਸਨੂੰ ਅੱਜ ਵੀ ਮਨਾਉਂਦੇ ਹਾਂ ਇਹ ਤਿਉਹਾਰ ਉਸੇ ਤਰ੍ਹਾਂ ਦੀ ਰੀਤ ਅਨੁਸਾਰ ਮਨਾਇਆ ਜਾਂਦਾ ਹੈ ਜਿਵੇਂ ਕਿ ਖੇਤਾਂ ਦੇ ਵਿੱਚੋਂ ਗੰਨੇ ਪੱਟ ਕੇ ਰੱਖੇ ਜਾਂਦੇ ਹਨ ਜੌਂ ਬੀਜੇ ਜਾਂਦੇ ਹਨ ਅਤੇ ਉੱਥੇ ਦੁਸਹਿਰੇ ਵਾਲੇ ਦਿਨ ਇੱਕ ਪਵਿੱਤਰ ਸ ਥਾਂ 'ਤੇ ਇਹ ਸਾਰਾ ਸਮਾਨ ਰੱਖ ਕੇ ਉੱਥੇ ਮੱਥਾ ਟੇਕਿਆ ਜਾਂਦਾ ਹੈ ਮਿੱਠੀ ਇੱਕ ਘਰ ਦੇ ਵਿੱਚ ਚੀਜ਼ ਬਣਾ ਲਈ ਜਾਂਦੀ ਹੈ ਇਹ ਪਰੰਪਰਾ ਉਸੇ ਤਰ੍ਹਾਂ ਤੁਰੀ ਆ ਰਹੀ ਹੈ ਦੂਜੇ ਨੰਬਰ 'ਤੇ ਜੇ ਅਸੀਂ ਵਿਆਹ ਦੀ ਗੱਲ ਕਰੀਏ ਤਾਂ ਵਿਆਹ ਦੇ ਸੰਦਰਭ ਵਿੱਚ ਇਹ ਕਿਹਾ ਜਾ ਸਕਦਾ ਹੈ ਕਿ ਵਿਆਹ ਵਿੱਚ ਜੋ ਰ ਰਸਮਾਂ ਰੀਤਾਂ ਨੇ ਉਹ ਅੱਜ ਵੀ ਉਸੇ ਤਰ੍ਹਾਂ ਕੀਤੀਆਂ ਜਾਂਦੀਆਂ ਨੇ ਜਿਵੇਂ ਵਿਆਹ ਸਮੇਂ ਲਾੜਾ ਸਾਰੇ ਲੋਕ ਦੇਵਤਿਆਂ ਨੂੰ ਮੱਥਾ ਟੇਕਦਾ ਹੈ ਉਸ ਤੋਂ ਬਾਅਦ ਉਹ ਵਿਆਹ ਤੋਂ ਬਾਅਦ ਜਦੋਂ ਉਹ ਸ਼ਾਮ ਨੂੰ ਲਾੜੀ ਨੂੰ ਘਰ ਲੈ ਕੇ ਆਉਂਦਾ ਹੈ ਤਾਂ ਉਸ ਵੇਲੇ ਮਾਂ ਪਾਣੀ ਵਾਰ ਕੇ ਪੀਂਦੀ ਹੈ ਔਰਤਾਂ ਲੋਕ ਗੀਤ ਗਾਉਂਦੀਆਂ ਹਨ ਇਹ ਪਰੰਪਰਾ ਮੁੱਢ ਤੋਂ ਚਲੀ ਆ ਰਹੀ ਹੈ ਅਤੇ ਅੱਜ ਵੀ ਉਸੇ ਤਰ੍ਹਾਂ ਹੀ ਕਾਇਮ ਹੈ